ਭੰਗੜੇ ਗਿੱਧੇ ਦਾ ਮੈਨੂੰ ਬਚਪਨ ਤੋਂ ਹੀ ਸ਼ੌਂਕ ਸੀ ਮੈਂ ਬਚਪਨ ਤੋਂ ਹੀ ਭੰਗੜਾ ਅਤੇ ਡਾਂਸ ਬੜਾ ਕਰਦੀ ਸੀ ਪਰ ਜਿੱਦਾਂ ਹੀ ਮੈਂ ਵੱਡੀ ਹੋਈ ਕੁਝ ਕਾਰਨਾ ਕਰਕੇ ਮੈਨੂੰ ਆਪਣਾ ਭੰਗੜਾ ਬੰਦ ਕਰਨਾ ਪਿਆ ਬਟ ਕੁਛ ਸਮੇਂ ਬਾਅਦ ਮੈਨੂੰ ਕਿਸੇ ਨੇ ਦੱਸਿਆ ਕਿ ਜੇਕਰ ਮੈਂ ਭੰਗੜਾ ਬੰਦ ਕੀਤਾ ਤਾਂ ਮੇਰੀ ਸਿਹਤ ਹੋਰ ਖ਼ਰਾਬ ਹੋ ਸਕਦੀ ਹੈ ਭੰਗੜੇ ਨੂੰ ਮੈਂ ਐਸ ਆ ਇੱਕ ਯੋਗਾ ਦੇ ਤੌਰ 'ਤੇ ਕਰਨਾ ਸਟਾਰਟ ਕੀਤਾ ਇੱਕ ਐਕਸਰਸਾਈਜ਼ ਦੇ ਤਰੀਕੇ 'ਤੇ ਕਰਨਾ ਸਟਾਰਟ ਕੀਤਾ ਜਿੱਦਾਂ ਹੀ ਮੈਂ ਭੰਗੜਾ ਕੀਤਾ ਮੇਰੀ ਬੋਡੀ ਦਾ ਸਟੈਮਿਨਾ ਵੱਧਦਾ ਗਿਆ ਵੱਧਦਾ ਗਿਆ ਮੈਂ ਘੰਟੋ ਘੰਟਾ ਭੰਗੜਾ ਕਰਦੀ ਸੀ ਮੈਂ ਕਈ ਵਾਰ ਅਕਸਰ ਕਮਰੇ ਵਿੱਚ ਬੰਦ ਰਹਿੰਦੀ ਸੀ ਇਕੱਲੀ ਰਹਿੰਦੀ ਸੀ ਜਿਸ ਕਰਕੇ ਮੈਂ ਡਿਪਰੈਸ਼ਨ ਦਾ ਸ਼ਿਕਾਰ ਹੋ ਗਈ ਸੀ ਫਿਰ ਮੈਨੂੰ ਮੇਰੇ ਘਰਦਿਆਂ ਨੇ ਕਿਹਾ ਕਿ ਜੇਕਰ ਤੂੰ ਭੰਗੜਾ ਛੱਡ ਦਿੱਤਾ ਤਾਂ ਤੂੰ ਇੱਦਾਂ ਹੀ ਡਿਪਰੈਸ਼ਨ ਵਿੱਚ ਜਾਂਦੀ ਰਹੇਂਗੀ ਕਿਉਂਕਿ ਭੰਗੜੇ ਦਾ ਸੰਬੰਧ ਖੁਸ਼ੀ ਨਾਲ ਆਉਂਦਾ ਹੈ ਤੁਸੀਂ ਭੰਗੜਾ ਪਾਉਂਦੇ ਹੋ ਤੁਸੀਂ ਵਧੀਆ ਵਧੀਆ ਗਾਣੇ ਸੁਣਦੇ ਹੋ ਅਤੇ ਤੁਹਾਡੇ ਮਨ ਦੇ ਅੰਦਰ ਜੋਸ਼ ਆਉਂਦਾ ਹੈ ਭੰਗੜੇ ਦਾ ਸੰਬੰਧ ਜੋਸ਼ ਨਾਲ ਹੈ ਜਿੱਦਾਂ ਹੀ ਮੈਂ ਜੋਸ਼ੀ ਜੋਸ਼ੀਲਾ ਫੀਲ ਕਰਦੀ ਸੀ ਮੈਂ ਭੰਗੜਾ ਕਰਨਾ ਸਟਾਰਟ ਕਰ ਦਿੰਦੀ ਸੀ ਭੰਗੜੇ ਦੇ ਕਰਨ ਦੇ ਨਾਲ ਮੈਂ ਬਹੁਤ ਖੁਸ਼ ਰਹਿਣਾ ਸ਼ੁਰੂ ਹੋ ਗਈ ਅਤੇ ਮੇਰੇ ਜਿੰਨੀਆਂ ਵੀ ਤਕਲੀਫਾਂ ਸੀਗੀਆਂ ਉਹ ਸਾਰੀਆਂ ਦੂਰ ਹੋ ਗਈਆਂ ਹੁਣ ਮੈਂ ਸਵੇਰ ਸ਼ਾਮ ਦਿਨ ਵਿੱਚ ਦੋ ਵਾਰ ਭੰਗੜਾ ਕਰਦੀ ਹਾਂ ਜਿਸ ਨਾਲ ਮੇਰਾ ਸਾਰਾ ਸਰੀਰ ਖੁੱਲ੍ਹ ਜਾਂਦਾ ਹੈ ਮੈਨੂੰ ਜਿਹੜੀ ਵੀ ਹੱਡੀ ਦੀ ਤਕਲੀਫਾਂ ਸੀ ਉਹ ਸਾਰੀਆਂ ਦੂਰ ਹੋ ਗਈਆਂ ਭੰਗੜਾ ਕਰਕੇ ਜਿਹੜਾ ਮੈਂ ਥੋੜ੍ਹਾ ਜਿਹਾ ਡਿਪਰੈਸ਼ਨ ਦਾ ਵੀ ਸ਼ਿਕਾਰ ਹੋ ਰਹੀ ਸੀ ਹੁਣ ਉਹ ਵੀ ਦੂਰ ਹੋ ਗਿਆ ਹੈ ਭੰਗੜਾ ਨੇ ਮੈਨੂੰ ਖੁਸ਼ੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਮੈਂ ਹੁਣ ਭੰਗੜਾ ਪਾਉਂਦੀ ਹਾਂ ਅਤੇ ਦਿਲ ਤੋਂ ਖੁਸ਼ ਰਹਿੰਦੀ ਹਾਂ ਅਤੇ ਮੈਂ ਇਸ ਲੋਕਾਂ ਨੂੰ ਵੀ ਸਲਾਹ ਦਊਂਗੀ ਕਿ ਜੇਕਰ ਤੁਸੀਂ ਡਿਪਰੈਸ਼ਨ ਦਾ ਸ਼ਿਕਾਰ ਹੋ ਰਹੇ ਹੋ ਤਾਂ ਤੁਸੀਂ ਘੱਟੋ ਘੱਟ ਦਿਨ ਵਿੱਚ ਇੱਕ ਵਾਰ ਭੰਗੜਾ ਜ਼ਰੂਰ ਕਰੋ ਇਹ ਤੁਹਾਨੂੰ ਦਿਲੋਂ ਖੁਸ਼ੀ ਦਵੇਗਾ